ਮੌਨਸੂਨ ਸੀਜ਼ਨ ਸਾਡੇ ਖੇਤਰ ਵਿੱਚ ਜਿਹੜੀ ਵਰਖਾ ਦੀ ਰੁੱਤ ਹੈ ਉਹ ਜੁਲਾਈ ਪੰਦਰਾਂ ਤਰੀਕ ਤੋਂ ਲੈ ਕੇ ਅਗਸਤ ਮਹੀਨੇ ਤੱਕ ਮੰਨੀ ਜਾਂਦੀ ਹੈ ਜਿਹਨੂੰ ਕਿ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਸਾਵਣ ਦਾ ਮਹੀਨਾ ਵੀ ਕਿਹਾ ਜਾਂਦਾ ਹੈ ਇਸ ਮਹੀਨੇ ਦੇ ਵਿੱਚ ਮੌਸਮ ਗਰਮੀ ਤੋਂ ਬਾਅਦ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੁੰਦੀ ਹੈ ਉਸ ਤੋਂ ਬਾਅਦ ਇੱਕਦਮ ਜਦੋਂ ਮੌਨਸੂਨ ਆਉਂਦਾ ਹੈ ਤਾਂ ਮੌਸਮ ਥੋੜ੍ਹਾ ਜਿਹਾ ਸਹੀ ਹੋ ਜਾਂਦਾ ਹੈ ਗਰਮੀ ਤੋਂ ਰਾਹਤ ਵੀ ਮਿਲਦੀ ਹੈ ਅਤੇ ਸਾਰੇ ਸੀਜ਼ਨ ਦੇ ਵਿੱਚ ਮੌਸਮ ਹੈ ਜਿਹੜਾ ਇਸ ਵੇਲੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਦੇ ਲਈ ਹੁੰਦਾ ਇਸ ਵੇਲੇ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਹੁੰਦੀ ਹੈ ਤਾਂ ਮੌਨਸੂਨ ਉਹਦੇ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ ਕਿਉਂਕਿ ਧਰਤੀ ਦੇ ਪਾਣੀ ਜਦੋਂ ਬਾਹਰ ਕੱਢਿਆ ਜਾਂਦਾ ਉਸ ਫਸਲ ਦੇ ਲਈ ਤਾਂ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ ਪਰ ਮੌਨਸੂਨ ਸੀਜ਼ਨ ਦੇ ਵਿੱਚ ਜਦੋਂ ਮੀਂਹ ਪੈ ਜਾਂਦਾ ਤਾਂ ਫਸਲ ਵੀ ਬਹੁਤ ਵਧੀਆ ਉੱਗਦੀ ਹੈ